ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਬਹੁਤ ਹੀ ਬਾਈਕਾਂ ਦਾ ਆ ਗਈਆਂ ਹਨ ਅਤੇ ਮੇਰੇ ਕੋਲ ਇਸ ਟਾਈਮ ਸਪਲੈਂਡਰ ਬਾਈਕ ਹੈ ਜਿਸ ਉੱਤੇ ਬੈਠ ਕੇ ਮੈਂ ਯਾਤਰਾਵਾਂ ਕਰਨ ਜਾਂਦਾ ਹਾਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਰਾਜਸਥਾਨ ਜੰਮੂ ਕਸ਼ਮੀਰ ਅਤੇ ਇਸ ਮੇਰੀ ਜੋ ਡਰੀਮ ਬਾਈਕ ਹੈ ਉਹ ਹਾਯਾਬੂਸਾ ਹੈ ਕਿਉਂਕਿ ਇਹ ਇੱਕ ਸਪੋਰਟਸ ਬਾਈਕ ਹੈ ਅਤੇ ਇਸ ਨਾਲ ਰੇਸਿੰਗ ਕਰਨ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਜਿਸ ਨੂੰ ਕਿ ਮੈਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਖਰੀਦਾਂਗਾ ਅਤੇ ਇਹ ਬਹੁਤ ਹੀ ਜ਼ਿਆਦਾ ਆਰਾਮਦਾਇਕ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਆਧੁਨਿਕ ਫੀਚਰਸ ਹਨ ਜਿਹਨਾਂ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆ ਸਕਦੀ ਧੰਨਵਾਦ